ਹੈਲੋ ਤੁਸੀਂ ਫਲਿੱਪਕਾਰਟ ਤੋਂ ਗੱਲ ਕਰਦੇ ਪਏ ਹੋ ਮੈਂ ਤੁਹਾਡੀ ਸਾਈਟ ਤੋਂ ਇੱਕ ਸੂਟ ਖਰੀਦਿਆ ਸੀ ਜਿਸਦਾ ਮੈਨੂੰ ਕਲਰ ਬਹੁਤ ਹੀ ਜ਼ਿਆਦਾ ਪਸੰਦ ਆਇਆ ਅਤੇ ਉਹ ਸੂਟ ਮੈਨੂੰ ਮਾਰਕੀਟ ਵਿੱਚ ਕਿਤੇ ਨਹੀਂ ਸੀ ਮਿਲ ਰਿਹਾ ਫਿਰ ਮੈਂ ਫਲਿੱਪਕਾਰਟ 'ਤੇ ਤੁਹਾਡੀ ਸਾਈਟ 'ਤੇ ਚੈੱਕ ਕੀਤਾ ਜਿਸ ਵਿੱਚ ਮੈਨੂੰ ਉਹ ਸੂਟ ਟਾਈਮ ਨਾਲ ਹੀ ਮਿਲ ਗਿਆ ਫਿਰ ਮੈਂ ਉਹ ਸੂਟ ਨੂੰ ਤੁਹਾਡੇ ਫਲਿੱਪਕਾਰਟ ਤੋਂ ਔਡਰ ਕੀਤਾ ਅਤੇ ਮੈਨੂੰ ਉਸਦਾ ਤਜਰਬਾ ਬਹੁਤ ਹੀ ਵਧੀਆ ਰਿਹਾ ਅਤੇ ਉਹ ਮੈਨੂੰ ਸੂਟ ਉਸ ਦੀ ਜਿਹੜੀ ਡਿਲੀਵਰੀ ਸੀ ਉਹ ਮੈਨੂੰ ਬਹੁਤ ਟਾਈਮ ਨਾਲ ਹੀ ਮਿਲ ਚੁੱਕੀ ਆ ਅਤੇ ਇਹ ਜਦੋਂ ਸੂਟ ਮੈਂ ਇਸਨੂੰ ਯੂਜ ਕੀਤਾ ਇਸ ਦੀ ਮੈਨੂੰ ਫਿਟਿੰਗ ਕਢਾਈ ਅਤੇ ਰੰਗ ਬਹੁਤ ਹੀ ਜ਼ਿਆਦਾ ਪਸੰਦ ਆਇਆ ਅਤੇ ਜਦੋਂ ਮੈਂ ਉਹ ਸੂਟ ਨੂੰ ਪਾਉਂਦੀ ਹਾਂ ਤਾਂ ਉਹ ਮੈਨੂੰ ਸਾਰੇ ਰਿਸ਼ਤੇਦਾਰ ਇਹ ਹੀ ਗੱਲ ਕਹਿੰਦੇ ਨੇ ਕਿ ਇਹ ਬਹੁਤ ਜ਼ਿਆਦਾ ਵਧੀਆ ਹੈ ਕਿੱਥੋਂ ਲਿਆ ਹੈ ਇਹ ਵੀ ਪੁੱਛਦੇ ਨੇ ਉਸਦਾ ਜਿਹੜਾ ਦੁਪੱਟਾ ਹੈ ਉਸ 'ਤੇ ਬਹੁਤ ਵਧੀਆ ਕੰਮ ਕੀਤਾ ਗਿਆ ਹੈ ਅਤੇ ਉਸ ਦੁਪੱਟੇ ਦਾ ਕਲਰ ਵ ਰੰਗ ਵੀ ਬਹੁਤ ਹੀ ਜ਼ਿਆਦਾ ਸੋਹਣਾ ਹੈ ਅਤੇ ਜਦੋਂ ਉਸਨੂੰ ਮੈਂ ਸੂਟ ਨੂੰ ਧੋ ਦਿੱਤਾ ਤਾਂ ਉਸਨੂੰ ਵਿੱਚ ਉਸਦੇ ਵਿੱਚ ਕੋਈ ਖਰਾਬੀ ਨਹੀਂ ਆਈ